ਸਾਡੇ ਘਰ ਵਿੱਚ ਕੋਈ ਖਾਸ ਤਕਨੀਕ ਜਾਂ ਚਾਲਦਾ ਯੂਜ਼ ਨਹੀਂ ਹੁੰਦੇ ਪਰ ਸਾਡੇ ਘਰ ਵਿੱਚ ਜਿਹੜਾ ਜਿੰਨਾਂ ਵੀ ਖਾਣੇ ਦਾ ਮਸਾਲਾ ਹੁੰਦਾ ਹੈ ਉਹ ਸਾਡੇ ਹੱਥੀਂ ਹੀ ਪਿਸਿਆ ਜਾਂਦਾ ਹੈ ਅਤੇ ਇਹ ਸਾਰਾ ਕੁਛ ਮੈਂ ਆਪਣੀ ਦਾਦੀ ਅਤੇ ਆਪਣੀ ਮਾਤਾ ਜੀ ਤੋਂ ਸਿੱਖਿਆ ਹੈ ਸਾਡੇ ਘਰ ਵਿੱਚ ਖਾਣੇ ਦਾ ਜਿੰਨਾਂ ਵੀ ਸਮਾਨ ਹੁੰਦਾ ਹੈ ਜਿਵੇਂ ਹਲਦੀ ਲਾਲ ਮਿਰਚ ਲੌਂਗ ਇਹ ਸਾਰਾ ਕੁਛ ਅਸੀਂ ਆਪਣੀ ਹੱਥੀਂ ਪੀਸਦੇ ਹਾਂ ਅਤੇ ਜਿਹੜਾ ਖਾਣਾ ਏ ਉਹ ਸਾਰਾ ਅਸੀਂ ਚੁੱਲੇ 'ਤੇ ਬਣਾਉਂਦੇ ਹਾਂ ਤਾਂ ਕਿ ਜਿਹੜਾ ਖਾਣੇ ਦਾ ਸਵਾਦ ਹੈ ਉਹ ਬਹੁਤ ਹੀ ਲਜ਼ੀਜ਼ ਅਤੇ ਪੌਸ਼ਟਿਕ ਬਣ ਸਕੇ ਖਾਣੇ ਦਾ ਸਵਾਦ ਲਜ਼ੀਜ਼ ਪੌਸ਼ਟਿਕ ਉਦੋਂ ਬਣਦਾ ਹੈ ਜਦੋਂ ਅਸੀਂ ਆਪਣੇ ਹੱਥੀਂ ਸਾਰਾ ਸਮਾਨ ਪੀਸਦੇ ਹਾਂ ਅਤੇ ਉਸਨੂੰ ਚੁੱਲੇ 'ਤੇ ਬਣਾਉਂਦੇ ਹਾਂ